ਮੈਂ ਆਪਣੇ ਜੀਵਨ ਵਿੱਚ ਫਿਲਮਾਂ ਬਣਾਉਂਦਾ ਹਾਂ ਅਤੇ ਇਹਨਾਂ ਦਾ ਕੰਮ ਕਰਦਾ ਹਾਂ ਇਹ ਕਰੀਅਰ ਦੀ ਸ਼ੁਰੂਆਤ ਮੈਂ ਆਪਣੇ ਕੋਲੇਜ ਟਾਈਮ ਦੇ ਵਿੱਚ ਕੀਤੀ ਸੀ ਅਤੇ ਮੈਂ ਸਕੂਲ ਟਾਈਮ ਦੇ ਵਿੱਚ ਵੀ ਥਿਏਟਰ ਕਰਦਾ ਰਿਹਾਂ ਮੈਂ ਸਟੇਜ 'ਤੇ ਬਹੁਤ ਸ਼ੋਅ ਲਗਾਏ ਅਤੇ ਇਹਨਾਂ ਦਾ ਮੈਨੂੰ ਬਹੁਤ ਬੈਨੀਫਿਟ ਹੋਇਆ ਕਿਉਂਕਿ ਅੱਜ ਕੱਲ੍ਹ ਦੇ ਅਜੋਕੇ ਸਮੇਂ ਵਿੱਚ ਲੋਕ ਨਾ ਫਿਲਮਾਂ ਦੇਖਣਾ ਬਹੁਤ ਪਸੰਦ ਕਰਦੇ ਨੇ ਜਾਂ ਕੋਈ ਨਾਟਕ ਹੋ ਗਿਆ ਮਨੋਰੰਜਨ ਵਾਲੀਆਂ ਚੀਜ਼ਾ ਪਸੰਦ ਕਰਦੇ ਨੇ ਅਤੇ ਇਹ ਬੰਦੇ ਦਾ ਇਨਕਮ ਵੀ ਬਹੁਤ ਅੱਛਾ ਹਾਈ ਹੁੰਦੀ ਹੈ ਪਰ ਇਹਦੇ 'ਚ ਗੱਲ ਮੇਨ ਹੁੰਦੀ ਹੈ ਚੱਲਣ ਦੀ ਕਿਉਂਕਿ ਸਾਡਾ ਰੱਬ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਚੱਲੀ ਜਾਂਦਾ ਅਤੇ ਅਸੀਂ ਇਹ ਕੰਮ ਕਰ ਰਹੇ ਹਾਂ ਸਾਨੂੰ ਇਨਕਮ ਵੀ ਬਹੁਤ ਮਿਲ ਰਹੀ ਹੈ ਇਸ ਚੀਜ਼ ਤੋਂ ਅਤੇ ਨਾਲ ਇੱਥੋਂ ਦਾ ਕਿ ਇਨਕਮ ਮੇਨ ਸੋਰਸ ਨਹੀਂ ਪਰ ਲੋਕਾਂ 'ਚ ਨਾਮ ਬਣਿਆ ਪਛਾਣ ਬਣੀ ਹੈ ਸਾਡੀ ਲੋਕ ਸਾਨੂੰ ਜਾਣਦੇ ਨੇ ਕਿ ਨਾਮ ਤੋਂ ਹੀ ਲੋਕਾਂ ਨੂੰ ਬੇਸ਼ੱਕ ਸਾਡੀ ਸ਼ਕਲ ਨਹੀਂ ਯਾਦ ਸਾਡਾ ਨਾਮ ਯਾਦ ਹੈ ਕਿ ਇਹ ਬੰਦਾ ਹੈਗਾ ਅਸੀਂ ਮੈ ਪੈਸਾ ਕਮਾਣ ਨਹੀਂ ਆਇਆ ਇੱਥੇ ਨਾਮ ਕਮਾਉਣ ਆਏ ਹੋਏ ਹਾਂ ਅਤੇ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਹੀ ਸਹੀ ਸੇਧ ਪ੍ਰਦਾਨ ਕਰ ਰਹੇ ਹਾਂ ਕਿਉਂਕਿ ਜਿਹੜੇ ਭੁੱਲੇ ਭੱਟਕੇ ਨੌਜਵਾਨ ਨੇ ਅਸੀਂ ਉਹਨਾਂ ਨੂੰ ਵੀ ਆਪਣੇ ਵੱਲ ਲਾਈਏ ਇਹ ਕਰੀਅਰ ਇਕੱਲਾ ਸਾਡਾ ਕਰੀਅਰ ਨਹੀਂ ਇਹ ਦੇਸ਼ ਨੂੰ ਵੀ ਸਿੱਧੇ ਮਾਰਗ 'ਤੇ ਲੈ ਕੇ ਜਾਣ ਵਾਲਾ ਕਰੀਅਰ ਹੈ ਤਾਂ ਇਸ ਕਰੀਅਰ ਨੂੰ ਅਸੀਂ ਚੁਣਿਆ ਅਤੇ ਇਸ ਦੇ ਵਿੱਚ ਰਹਿਣ ਦਾ ਅਸੀਂ ਫੈਸਲਾ ਕੀਤਾ